ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਜੀ ਹਾਂਜੀ ਮੈਡਮ ਰਜਿੰਦਰਾ ਹੋਸਪੀਟਲ ਤੋਂ ਬੋਲ ਰਹੇ ਹਾਂ ਹਾਂਜੀ ਦੱਸੋ ਜੀ ਹਾਂਜੀ ਮੈਡਮ ਤੁਸੀਂ ਜੇ ਕਿਸੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਹੈ ਤਾਂ ਤੁਸੀਂ ਸਾਡੇ ਹੋਸਪੀਟਲ 'ਚ ਆ ਸਕਦੇ ਹੋ ਅਤੇ ਤੁਹਾਨੂੰ ਇੱਥੇ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਏਗੀ ਜਿੱਦਾਂ ਦੀ ਵੀ ਪ੍ਰੋਬਲਮ ਹੈ ਉਸਦੇ ਰਿਲੇਟਿਡ ਤੁਹਾਨੂੰ ਸੁਵਿਧਾ ਪ੍ਰੋਵਾਈਡ ਕੀਤੀ ਜਾਏਗੀ ਅਤੇ ਇੱਥੇ ਤੁਹਾਡੇ ਰਹਿਣ ਲਈ ਵੀ ਬਹੁਤ ਵਧੀਆ ਇੰਤਜ਼ਾਮ ਕੀਤਾ ਜਾਏਗਾ ਤੁਹਾਡੇ ਖਾਣੇ ਦਾ ਖਾਸ ਧਿਆਨ ਰੱਖਿਆ ਜਾਂਦਾ ਅਤੇ ਜੇ ਕ ਤੁਹਾਡੇ ਨਾਲ ਤੁਹਾਡੀ ਫੈਮਲੀ ਆ ਰਹੀ ਹੈ ਉਹਦੇ ਵੀ ਰਹਿਣ ਲਈ ਪੇਸ਼ੈਂਟ ਦੇ ਨਾਲ ਅਟੈਂਡੈਂਟ ਦਾ ਰਹਿਣ ਦਾ ਵੀ ਇੱਥੇ ਬਹੁਤ ਹੀ ਵਧੀਆ ਅਰੇਂਜਮੈਂਟ ਹੈ ਅਤੇ ਇੱਥੇ ਜਿਹੜੇ ਇੱਥੇ ਡੋਕਟਰ ਹੈ ਉਹ ਵੀ ਬੜੇ ਹੀ ਐਜੂਕੇਟਡ ਹੈ ਅਤੇ ਬੜਾ ਹੀ ਵਧੀਆ ਤਰੀਕੇ ਨਾਲ ਇੱਥੇ ਇੱਕ ਪੇਸ਼ੈਂਟ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਤੁਹਾਨੂੰ ਮੈਡਮ ਕੋਈ ਵੀ ਦਿੱਕਤ ਨਹੀਂ ਆਏਗੀ ਤੁਸੀਂ ਜਦੋਂ ਵੀ ਆਉਣਾ ਚਾਹੁੰਦੇ ਹੋ ਆਪਣਾ ਇਲਾਜ ਕਰਨ ਲਈ ਉਸ ਤੋਂ ਪਹਿਲਾਂ ਆ ਸਾਨੂੰ ਦੱਸ ਦੇਣਾ ਕਿਉਂ ਅਤੇ ਜਿਹੜੇ ਵੀ ਤੁਹਾਡੇ ਟੈਸਟ ਨੇ ਐਕਸਰੇ ਹੋ ਗਏ ਸਿਟੀ ਸਕੈਨ ਹੋ ਗਈ ਅਤੇ ਇਸ ਤੋਂ ਇਲਾਵਾ ਕੋਈ ਵੀ ਬਲੱਡ ਟੈਸਟ ਹੋ ਗਿਆ ਸਾਰੇ ਹਰ ਤਰ੍ਹਾਂ ਦੇ ਟੈਸਟ ਸਾਡੇ ਹੋਸਪਿਟਲ ਦੇ ਅੰਦਰ ਹੀ ਕੀਤੇ ਜਾਂਦੇ ਨੇ ਤੁਹਾਨੂੰ ਬਾਹਰ ਜਾਣ ਦੀ ਵੀ ਕੋਈ ਦਿੱਕਤ ਨਹੀਂ ਆਏਗੀ ਜੇ ਤੁਸੀਂ ਇਕੱਲੇ ਵੀ ਆਉਂਦੇ ਹੋ ਤਾਂ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਕਿ ਹਾਂ ਪੇਸ਼ੈਂਟ ਨੂੰ ਜੇ ਤੁਸੀਂ ਇਕੱਲੇ ਆਉਂਦੇ ਹੋ ਤਾਂ ਪੇਸ਼ੈਂਟ ਦੇ ਜਿਹੜੇ ਟੈਸਟ ਨੇ ਬਲੱਡ ਦੇ ਹੋ ਗਏ ਸਿਟੀ ਸਕੈਨ ਐਕਸਰੇ ਈਸੀਜੀ ਵਗੈਰਾ ਉਹ ਸਾਡਾ ਸਟਾਫ ਹੈ ਜਿਹੜਾ ਉਹ ਖੁਦ ਕਰਦਾ ਅਤੇ ਜੇ ਤੁਹਾਡਾ ਫੈਮਿਲੀ ਮੈਂਬਰ ਕੋਈ ਆਉਂਦਾ ਤਾਂ ਵੀ ਕੋਈ ਦਿੱਕਤ ਨਹੀਂ ਹੈ ਤੁਸੀਂ ਮੈਮ ਜਦੋਂ ਮਰਜ਼ੀ ਚਾਹੇ ਆ ਸਕਦੇ ਹੋ ਤੁਹਾਨੂੰ ਅਸੀਂ ਆਸ਼ਾ ਕਰਦੇ ਹਾਂ ਕਿ ਇਸ ਹੋਸਪਿਟਲ ਦੇ ਵਿੱਚ ਵਧੀਆ ਤੋਂ ਵਧੀਆ ਟ੍ਰੀਟਮੈਂਟ ਦਿੱਤਾ ਜਾਏਗਾ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਮੈਡਮ ਠੀਕ ਹੈ ਮੈਡਮ ਆਉਣ ਤੋਂ ਪਹਿਲਾਂ ਇੱਕ ਵਾਰੀ ਸਾਨੂੰ ਫੋਨ ਇਨਫੋਰਮ ਕਰ ਦਿਓ ਅਤੇ ਅਸੀਂ ਤੁਹਾਡਾ ਟਾਈਮ ਲਈ ਤੁਹਾਨੂੰ ਦੱਸ ਦਾਂਗੇ ਕਿਸ ਦਿਨ ਤੁਸੀਂ ਹੋਸਪਿਟਲ ਜਾਣਾ

ਓਕੇ ਜੀ